ਰੋਜ਼ਾਨਾ ਕਸਰਤ ਕਰਨ ਨਾਲ ਅਤੇ ਦੌੜਨ ਨਾਲ ਜੋ ਵਿਅਕਤੀ ਤੰਦਰੁਸਤ ਰਹਿੰਦਾ ਆ ਇਸਦੇ ਨਾਲ ਬੰਦਾ ਜੋ ਆਪਣੀ ਸਰੀਰਕ ਤੌਰ 'ਤੇ ਫਿਟ ਰਹਿੰਦਾ ਆ ਦੌੜਨ ਨਾਲ ਵਿਅਕਤੀ ਦੀ ਜਿਹੜੀ ਹੈਗੀ ਦਿ ਦਿਲ ਦੀ ਧੜਕਣ ਆ ਜੋ ਵੀ ਸਟੇਬਲ ਹੋ ਜਾਂਦੀ ਆ ਸਾਹ ਹੀ ਗਤੀ ਵੀ ਸਟੇਬਲ ਹੋ ਜਾਂਦੀ ਆ ਦੌੜਨ ਨਾਲ ਬੰਦੇ ਦੇ ਅੰਦਰ ਚੁਸਤੀ ਫੁਰਤੀ ਆਉਂਦੀ ਆ ਬੰਦਾ ਸਾਰਾ ਦਿਨ ਚੁਸਤ ਫੁਰਤ ਰਹਿ ਕੇ ਆਪਣਾ ਕੰਮ ਕਰਦਾ ਆ